ਜੀ ਹਾਂ ਬਿਲਕੁਲ ਡਾਂਸ ਨੇ ਮੇਰੀ ਜ਼ਿੰਦਗੀ ਵਿੱਚ ਕਾਫੀ ਮੋਟੀਵੇਟ ਕੀਤਾ ਇਨ ਪੋਜੀਟਿਵ ਵੇਅ ਕੁਝ ਇਸ ਤਰ੍ਹਾਂ ਜਿਵੇਂ ਕਿ ਆਪਣੀ ਮੈਂਟਲ ਹੈਲਥ 'ਚ ਆਪਾਂ ਦੇਖ ਸਕਦੇ ਇਮਪਰੂਵਮੈਂਟ ਆਉਂਦੀ ਇਸ ਨਾਲ ਡਾਂਸ ਨਾਲ ਆਪਣੀਆਂ ਡਾਂਸ ਦੀ ਮੂਵਮੈਂਟ ਵਿੱਚ ਇੱਕ ਮਸਲ ਸੰਟ੍ਰੈਂਥ ਵਿੱਚ ਵਾਧਾ ਹੁੰਦਾ ਇਹਦੇ ਨਾਲ ਆਪਣੀ ਮਤਲਬ ਮੈਂਟਲ ਹੈਲਥ 'ਚ ਕਾਫੀ ਇਮਪਰੂਵਮੈਂਟ ਆਉਂਦੀ ਆਪਣਾ ਮੂਡ ਆਪਣਾ ਐਟੀਟਿਊਡ ਬਿਹੇਵੀਅਰ ਵਗੈਰਾ ਵੀ ਚੇਂਜ ਹੁੰਦਾ ਠੀਕ ਹੈ ਇਹਦੇ ਨਾਲ ਆਪਣਾ ਕਿ ਆਪਣੀ ਜੇ ਡਿਪਰੈਸ਼ਨ ਹੈ ਕੋਈ ਵੀ ਐਗਜਾਇਟੀ ਆਪਾਂ ਨੂੰ ਡਰ ਹੈ ਕੋਈ ਠੀਕ ਹੈ ਕੋਈ ਚਿੰਤਾ ਉਸਨੂੰ ਆਪਾਂ ਆਰਾਮ ਨਾਲ ਦੂਰ ਕਰ ਸਕਦੇ ਹਾਂ ਫਿਜੀਕਲ ਹੈਲਥ 'ਚ ਵੀ ਕੁਝ ਇਸ ਤਰ੍ਹਾਂ ਆਪਾਂ ਨੂੰ ਮੋਟੀਵੇਟ ਕਰਦੇ ਡਾਂਸ ਜਿਵੇਂ ਕਿ ਆਪਣੀ ਮਸਲ ਜਿਵੇਂ ਮੈਂ ਦੱਸਿਆ ਮਸਲ ਸੰਟ੍ਰੈਂਥ ਵਿੱਚ ਵਾਧਾ ਕਰਦਾ ਠੀਕ ਹੈ ਉਸਨੂੰ ਟੋਨ ਵਿੱਚ ਕਰਨ ਵਿੱਚ ਹੈਲਪ ਕਰਦਾ ਠੀਕ ਹੈ ਉਹਦੀ ਸੰਟ੍ਰੈਂਥ ਨੂੰ ਵਧਾਉਣ 'ਚ ਹੈਲਪ ਕਰਦਾ ਠੀਕ ਹੈ ਇਹਦੇ ਨਾਲ ਆਪਾਂ ਆਪਣੀ ਫਿਟਨੈਸ ਨੂੰ ਵੀ ਮੈਨਟੇਨ ਕਰ ਆਪਣੀ ਵੇਟ ਮੈਨੇਜਮੈਂਟ ਵੀ ਪ੍ਰੋਪਰ ਹੋ ਸਕਦੀ ਡਾਂਸ ਨਾਲ ਉਸ ਤੋਂ ਬਾਅਦ ਸੋਸ਼ਲ ਕਨੈਕਸ਼ਨ ਵੀ ਬਿਲਡ ਕਰਨ ਵਿੱਚ ਹੈਲਪ ਕਰ ਸਕਦੇ ਡਾਂਸ ਜਿਸ ਤਰ੍ਹਾਂ ਜਿਵੇਂ ਕੋਈ ਵੀ ਪੀਅਰਸ ਵਗੈਰਾ ਹੁੰਦੇ ਠੀਕ ਹੈ ਉਹਨਾਂ ਨਾਲ ਆਪਣਾ ਕਨੈਕਸ਼ਨ ਬਿਲ ਕਰਨ ਵਿੱਚ ਹੈਲਪ ਕਰ ਸਕਦਾ ਡਾਂਸ ਇਹਦੇ ਨਾਲ ਆਪਣੇ ਕੋਨਫੀਡੈਂਸ ਵੀ ਸਗੋਂ ਬਿਲਡ ਹੁੰਦਾ ਠੀਕ ਹੈ ਆਪਾਂ ਸਟੇਜ਼ 'ਤੇ ਆਉਣ ਦੇ ਕੇਪਏਬਲ ਆਪਾਂ ਹੋਰ ਵੀ ਪਾਰਟੀਸਪੇਟ ਕਰਦੇ ਹਾਂ ਭੱਜ ਨੱਠ ਕੇ ਠੀਕ ਹੈ ਇਹ ਨਾਲ ਆਪਣਾ ਕਿ ਕੋਨਫੀਡੈਂਸ ਲੈਵਲ ਇੰਪਰੂਵਮੈਂਟ ਹੁੰਦੀ ਹੈ ਇਹਦੇ ਨਾਲ ਇੱਕ ਟੀਮ ਵਰਕ ਦਾ ਵੀ ਪਤਾ ਲੱਗਦਾ ਕੋਪਰੇਟਿਵ ਮੈਨਰ 'ਚ ਆਪਾਂ ਕਿਸ ਤਰ੍ਹਾਂ ਕੰਮ ਕਰਨਾ ਠੀਕ ਹੈ ਜੋ ਮੰਨੋ ਕੋਈ ਭੰਗੜੇ ਦੀ ਟੀਮ ਹੈ ਤਾਂ ਉਸ ਟੀਮ ਵਿੱਚ ਜਦੋਂ ਆਪਾਂ ਵੱਖ ਵੱਖ ਠੀਕ ਹੈ ਬਿਹੇਵੀਅਰ ਦੇ ਆਪਣੇ ਪਾਰਟੀਸਪੈਂਟਸ ਨਾਲ ਰਹਿੰਦੇ ਹਾਂ ਤਾਂ ਆਪਣੇ ਬਿਹੇਵੀਅਰ ਵਿੱਚ ਵੀ ਥੋੜ੍ਹੇ ਬਹੁਤ ਚੇਂਜਿਸ ਆਉਂਦੇ ਆਪਣੀ ਜਿਹੜੀ ਠੀਕ ਹੈ ਸਮਝਣ ਦੀ ਸਮਰੱਥਾ ਕੋਪ੍ਰੇਟਿਵ ਕਿੱਦਾਂ ਜਸਟਮੈਂਟ ਕਰਨੀ ਹੈ ਇਹਨਾਂ ਵਿੱਚ ਵੀ ਤਬਦੀਲੀਆਂ ਆਉਂਦੀਆਂ ਠੀਕ ਹੈ ਆਪਣੀ ਰਿਸਪੋਂਸੀਬਿਲਟੀ ਦਾ ਵੀ ਪਤਾ ਲੱਗਦਾ ਕਿ ਕਿ ਆਪਣੀ ਕੀ ਰਿਸਪਾਂਸੀਬਿਲਟੀ ਹੈ ਅਤੇ ਇਸ ਨਾਲ ਇਹ ਵੀ ਪਤਾ ਲੱਗਦਾ ਡਾਂਸ ਕਿੰਨਾ ਹੋਰ ਕੀ ਹੈ ਕਿ ਐਕਸਪ੍ਰੈਸਿੰਗ ਫੀਲਿੰਗਸ ਇੱਕ ਤਰ੍ਹਾਂ ਦੀ ਡਾਂਸਿੰਗ ਨਾਲ ਆਪਾਂ ਐਕਸਪ੍ਰੈਸ ਕਰ ਸਕਦੇ ਆਪਣੀਆਂ ਫੀਲਿੰਗਸ ਜਿਹੜੀ ਕਿ ਅਕਸਰ ਵਰਡਸ ਕਦੇ ਨਹੀਂ ਕਦੇ ਨਹੀਂ ਦੱਸ ਸਕਦੇ ਹੁੰਦੇ ਪਰ ਆਪਣੀਆਂ ਫੀਲਿੰਗ ਦੱਸ ਦਿੰਦੀਆਂ ਠੀਕ ਹੈ ਇਹਦੇ ਮੈਂ ਆਪਣਾ ਜਿਹੜਾ ਡਰ ਆ ਉਸ ਨੂੰ ਵੀ ਖਤਮ ਕਰਨ ਵਿੱਚ ਕਾਫੀ ਮਦਦ ਕਰਦੀ ਠੀਕ ਹੈ ਇੱਕ ਤਰ੍ਹਾਂ ਦੀ ਇੱਕ ਜੋ ਇਹ ਆ ਠੀਕ ਹੈ ਆਪਣੀ ਜਿਵੇਂ ਆ ਡੇਲੀ ਲਾਈਫ ਦੀ ਐਕਟੀਵਿਟੀਜ਼ ਹੈ ਜਦੋਂ ਆਪਣਾ ਸਟ੍ਰੈਸ ਹੈ ਇੱਕ ਡਾਂਸ ਆਪਾਂ ਉਸਨੂੰ ਥੋੜ੍ਹੇ ਟਾਈਮ ਲਈ ਪਰਾਂ ਰੱਖ ਕੇ ਉਸਨੂੰ ਇੰਜੋਏ ਕਰ ਸਕਦੇ ਹਾਂ